ਤੰਦਰੁਸਤੀ ਹਰ ਇੱਕ ਮਨੁੱਖ ਦੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਹੈਲਥ ਪ੍ਰਤੀ ਘੱਟ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੇ ਸਾਰੇ ਮਤਲਬ ਹਸਪਤਾਲ ਵਗੈਰਾ ਹੈਗੇ ਨੇ ਉਹ ਸਾਰੇ ਪੇਂਡੂ ਖੇਤਰਾਂ ਵਿੱਚ ਘੱਟ ਹੁੰਦੇ ਨੇ ਅਤੇ ਲੋਕ ਬਾਹਰ ਜਾਣ ਤੋਂ ਗੁਰਹੇਜ਼ ਕਰਦੇ ਹਨ ਅਤੇ ਇਸ ਲਈ ਲੋਕ ਬਿਮਾਰੀਆਂ ਪਾ ਪਾਲ ਲੈਂਦੇ ਹਨ ਉਹਨਾਂ ਨੂੰ ਦੁੱਖ ਘੱਟ ਦੁੱਖ ਆਉਂਦੇ ਹਨ ਅਤੇ ਪਰ ਹੁਣ ਹੁਣ ਦ ਭਾਰਤ ਦਿਨੋ ਦਿਨ ਤਰੱਕੀ ਕਰ ਰਿਹਾ ਬਠਿੰਡੇ ਵਿੱਚ ਏਮਜ ਹਸਪਤਾਲ ਨਵਾਂ ਖੁੱਲ੍ਹ ਗਿਆ ਹੈ ਜਿ ਜਿਹੜਾ ਕਿ ਬਹੁਤ ਹੀ ਜਿਹੜਾ ਕਿ ਆਮ ਲੋਕਾਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਾਬਿਤ ਹੋ ਰਿਹਾ ਏ ਪੇਂਡੂ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਕਿਉਂਕਿ ਇੱਥੇ ਬਹੁਤ ਵਧੀਆ ਤਰੀਕੇ ਨਾਲ ਕੇਅਰ ਕੀਤੀ ਜਾਂਦੀ ਹੈ ਮਰੀਜ਼ ਦੀ ਉਹਦੀਆਂ ਰੋਗ ਬਹੁਤ ਵਧੀਆ ਡਾਕਟਰ ਨੇ ਜਿਹੜੇ ਰੋ ਜਿਹੜੇ ਰੋਗਾਂ ਨੂੰ ਠੀਕ ਕਰਦੇ ਨੇ ਏਮਜ ਹਸਪਤਾਲ ਵਿੱਚ ਖਰਚਾ ਵੀ ਬਹੁਤ ਘੱਟ ਹੈ ਜਿਸ ਨਾਲ ਵੱਧ ਤੋਂ ਵੱਧ ਮਰੀਜ਼ਾਂ ਨੂੰ ਲਾਭ ਹੋ ਸਕਦਾ ਲਾਭ ਹੋ ਸਕਦਾ ਹੈ ਏਮਜ ਹਸਪਤਾਲ ਵਿੱਚ ਪਹਿਲਾਂ ਆਫਲਾਈਨ ਸਿਸਟਮ ਸੀ ਹੁਣ ਦਿਨੋ ਦਿਨ ਚੇਂਜ ਹੋ ਰਿਹਾ ਹੈ ਇਸ ਵਿੱਚ ਹੁਣ ਆਨਲਾਈਨ ਸਿਸਟਮ ਹੋ ਗਿਆ ਹੈ ਤਾਂ ਇਸ ਨਾਲ ਬਹੁਤ ਘੱਟ ਪਰੇਸ਼ਾਨੀ ਹੁੰਦੀ ਹੈ ਇਸ ਤਰ੍ਹਾਂ ਹੀ ਅਯੁਸ਼ਮਾਨ ਕਾਰਡ ਵਗੈਰਾ ਦੀ ਇੱਥੇ ਵਰਤੋਂ ਹੁੰਦੀ ਹੈ ਜਿਸ ਨਾਲ ਵੱਧ ਤੋਂ ਵੱਧ ਮਰੀਜ਼ ਇਹਦਾ ਲਾਭ ਉਠਾ ਸਕਦੇ ਨੇ ਅਤੇ ਆਪਦੇ ਵੱਡੇ ਤੋਂ ਵੱਡੇ ਰੋਗਾਂ ਨੂੰ ਠੀਕ ਕਰ ਸਕਦੇ ਨੇ